ਭਾਰਤ ਦੇ ਦੇ ਸਿਆਸੀ ਵਿਸ਼ੇ ਵਿੱਚ ਪੰਜਾਬ ਦੀ ਬਹੁਤ ਭੂਮਿਕਾ ਰਹੀ ਹੈ ਕਿਉਂਕਿ ਭਾਰਤ ਬਹੁਤ ਹੀ ਵਧੀਆ ਦੇਸ਼ ਹੈ ਇਸ ਵਿੱਚ ਜੋ ਪਾਰਟੀਆਂ ਹਨ ਉਹ ਬਹੁਤ ਹੀ ਵਧੀਆ ਕੰਮ ਕਰਦੀਆਂ ਹਨ ਪਰ ਹੁਣ ਭਾਰਤ ਵਿੱਚ ਜਾਤੀਵਾਦ ਨੂੰ ਲੈ ਕੇ ਬਹੁਤ ਹੀ ਝਗੜੇ ਹੁੰਦੇ ਹਨ ਲੋਕ ਆਪਸ ਵਿੱਚ ਬਹੁਤ ਝਗੜੇ ਕਰਦੇ ਹਨ ਭਾਰਤ ਵਿੱਚ ਹੁਣ ਨਸ਼ਿਆਂ ਬਹੁਤ ਹੀ ਵੱਧ ਚੁੱਕਿਆ ਹੈ ਜਿਸ ਕਰਕੇ ਹੁਣ ਮਤ ਨਸ਼ਾ ਬਹੁਤ ਹੈ ਭਾਰਤ ਦੀ ਇਹ ਘਟਨਾ ਹੈ ਕਿ ਭਾ ਭਾਰਤ ਵਿੱਚ ਜਾਤੀਵਾਦ ਨੂੰ ਲੈ ਕੇ ਪੰਜਾਬ ਨੂੰ ਵੀ ਵਿੱਚ ਆਉਣਾ ਪਿਆ ਕਿਉਂਕਿ ਪੰਜਾਬ ਵਿੱਚ ਜਿਹੜੀਆਂ ਹੁਣ ਰਾਜਨੀਤਿਕ ਪਾਰਟੀਆਂ ਹਨ ਉਹ ਬਹੁਤ ਵਧੀਆ ਹਨ ਉਹ ਵਧੀਆ ਕੰਮ ਕਰਦੀਆਂ ਹਨ ਅਤੇ ਪੰਜਾਬ ਨੂੰ ਵੀ ਇਸ ਕਰਕੇ ਰਾਜਨੀਤੀ ਦੇ ਰੂਪ ਵਿੱਚ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਕਰਕੇ ਭਾਰਤ ਪੰਜਾਬ ਦੇ ਰੂਪ ਵਿ ਪੰਜਾਬ ਨੂੰ ਵੀ ਰਾਜਨੀਤੀ ਦੇ ਰੂਪ ਵਿੱਚ ਕੋਈ ਵਧੀਆ ਹੋ ਸਕੇ ਇਸ ਕਰਕੇ ਥੋੜ੍ਹਾਂ ਜਿਹਾ ਔਖਾ ਸੀ